ਹੈਲੋ ਸਾਸ਼ੀਕਾਲ ਜੀ ਊਬਰ ਸਰਵਿਸ ਤੋਂ ਬੋਲ ਰਹੇ ਮੇਰਾ ਨਾਮ ਸੁਖਮਨੀ ਕੌਰ ਹੈ ਅਤੇ ਮੈਂ ਤਰਨਤਾਰਨ ਦੀ ਨਿਵਾਸੀ ਹਾਂ ਕੁੱਝ ਦਿਨ ਪਹਿਲਾਂ ਹੀ ਮੇਰੇ ਪਰਿਵਾਰ ਦੀ ਸਲਾਹ ਬਣੀ ਕਿ ਕਿਉਂ ਨਾ ਕਿਤੇ ਘੁੰਮਣ ਜਾਇਆ ਜਾਵੇ ਮੌਸਮ ਵੀ ਬਹੁਤ ਵਧੀਆ ਸੀ ਅਤੇ ਮੇਰੇ ਕੁਛ ਰਿਸ਼ਤੇਦਾਰ ਵੀ ਕੈਨੇਡਾ ਤੋਂ ਆ ਰਹੇ ਸੀ ਅਤੇ ਅਸੀਂ ਇਸ ਤਰ੍ਹਾਂ ਫਿਰ ਸਲਾਹ ਬਣਾਈ ਕਿ ਕਿਉਂ ਨਾ ਸ਼ਿਮਲਾ ਹੀ ਜਾਇਆ ਜਾਵਾ ਸ਼ਿਮਲਾ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇਸ ਦੇ ਪਹਾੜ ਵੀ ਬਹੁਤ ਆਕਰਸ਼ਿਤ ਹਨ ਸੋ ਅਸੀਂ ਸ਼ਿਮਲਾ ਜਾਣ ਬਾਰੇ ਸੋਚ ਲਿਆ ਸੀ ਊਬਰ ਸਰਵਿਸ ਦੀ ਮੈਂ ਬਹੁਤ ਚਿਰ ਤੋਂ ਵਰਤੋਂ ਕਰਦੀ ਆ ਰਹੀ ਹਾਂ ਅਤੇ ਊਬਰ ਸਰਵਿਸ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਇਸ ਲਈ ਅਸੀਂ ਸਵੇਰੇ ਪੰਜ ਵਜੇ ਦੀ ਊਬਰ ਕੈਬ ਬੁੱਕ ਕੀਤੀ ਅਸੀਂ ਡਰਾਈਵਰ ਨੂੰ ਕਿੰਨੀ ਵਾਰੀ ਕੋਲ ਕਰ ਚੁੱਕੇ ਸੀ ਪਰ ਡਰਾਈਵਰ ਨੇ ਇੱਕ ਕੋਲ ਨਹੀਂ ਚੁੱਕੀ ਅਤੇ ਸੱਤ ਵਜੇ ਦਾ ਇਸ ਤਰਾਂ ਟਾਈਮ ਹੋ ਗਿਆ ਅਤੇ ਡਰਾਈਵਰ ਅਜੇ ਤੱਕ ਨਹੀਂ ਆ ਰਿਹਾ ਮੈਂ ਆਪ ਜੀ ਨੂੰ ਆਸ਼ਾ ਕਰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਕਿਸੇ ਹੋਰ ਕੈਬ ਦਾ ਸੰਬੰਧ ਕਰੋ ਜਾਂ ਫਿਰ ਇਸੇ ਕੈਬ ਦੇ ਡਰਾਈਵਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ